ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਆ ਹਾਲ ਚਾਲ ਹੈ ਹਾਂਜੀ ਹਾਂਜੀ ਆਪਾਂ ਵਧੀਆ ਜੀ

ਹਰੀ ਕ੍ਰਾਂਤੀ ਨਾਲ ਭਾਅ ਜੀ ਪ੍ਰਭਾਵ ਤਾਂ ਪੰਜਾਬ 'ਤੇ ਬਹੁਤ ਪਿਆ ਹੈਗਾ ਇੱਕ ਤਾਂ ਸਭ ਨਾਲੋਂ ਪਹਿਲਾਂ ਪਿਆ ਹੈਗਾ ਪੰਜਾਬ ਦੀ ਟੈਕਨੋਲਜੀ 'ਤੇ ਪ੍ਰਭਾਵ ਅਤੇ ਖੇਤੀ 'ਤੇ ਪ੍ਰਭਾਵ ਪਿਆ ਹੈ ਜੀ ਜਿੱਦਾਂ ਹੁਣ ਹਰੀ ਕ੍ਰਾਂਤੀ ਆਈ ਸੀ ਨਾ ਇਹ ਆਈ ਸੀ ਜੀ ਜਿੱਦਾਂ ਹੁਣ ਆਪਾਂ ਲਾਲ ਬਹਾਦੁਰ ਸ਼ਾਸਤਰੀ ਜੀ ਨਹੀਂ ਸੀ ਆਪਣੇ ਪ੍ਰਧਾਨ ਮੰਤਰੀ ਜੀ ਉਸ ਟਾਇਮ ਆਈ ਸੀਗੀ ਉਹਨਾਂ ਨੇ ਲੈ ਕੇ ਆਉਂਦੀ ਸੀਗੀ ਇਹ ਇੱਕ ਨੌਹ ਨੌਰਮਨ ਬੋਰਲੌਗ ਨਾਮ ਦਾ ਬੰਦਾ ਸੀਗਾ ਬਾਹਰ ਯੂਨੀਵਰਸਿਟੀ 'ਚ ਪੜ੍ਹਿਆ ਸੀਗਾ ਅਮੈਰੀਕਾ 'ਚ ਉਹ ਉਹ ਲੈ ਕੇ ਆਇਆ ਸੀਗਾ ਇੱਥੇ ਉਹਨੇ ਨਾ ਜਿੱਦਾਂ ਹੁਣ ਇੱਥੇ ਨਾ ਜਿਹੜੀਆਂ ਵੱਧ ਝਾੜ੍ਹ ਵਾਲੀਆਂ ਫਸਲਾਂ ਤੀਆਂ ਜਿੱਦਾਂ ਫਰਟੀਲਾਈਜਰ ਵਗੈਰਾ ਲਾ ਕੇ ਉਹਨਾਂ ਨੇ ਉਹਨਾਂ ਨੇ ਜਿਹੜਾ ਇੱਥੇ ਦੀ ਜਿਹੜੀ ਜਿਹੜਾ ਮਤਲਬ ਜਿੱਦਾਂ ਇੰਡੀਆ 'ਚ ਅੰਨ ਦੀ ਸ਼ੌਰਟੇਜ ਨਹੀਂ ਹੈਗੀ ਸੀਗੀ ਉਹਨੂੰ ਸਾਰੀ ਨੂੰ ਪੂਰਾ ਕਰਨ ਵਾਸਤੇ ਗ੍ਰੀਨ ਰੈਵਲਿਊਸ਼ਨ ਦਾ ਇੱਕ ਬਹੁਤ ਬੜਾ ਯੋਗਦਾਨ ਰਿਹਾ ਇ ਇਹਨੇ ਇਹਨੇ ਇੱਕ ਤਾਂ ਫਸਲਾਂ ਦਾ ਝਾੜ੍ਹ ਵਧਾਇਆ ਹੈਗਾ ਫਸਲਾਂ ਦਾ ਝਾੜ੍ਹ ਵਧਣ ਕਰਕੇ ਹੋਇਆ ਅਸੀਂ ਪਹਿਲਾਂ ਤਾਂ ਲੋਕਾਂ ਤੇ ਮੁੱਲ ਲੈਂਦੇ ਤੇ ਹੋਰ ਦੇਸ਼ਾਂ 'ਤੇ ਫਸਲਾਂ ਮੁੱਲ ਹੁਣ ਅਸੀਂ ਹੁਣ ਅਸੀਂ ਬਾਹਰ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਆਪਣੀਆਂ ਹੀ ਹੁਣ ਤੁਸੀਂ ਦੇਖ ਸਕਦੇ ਹੈ ਹੁਣ ਸਾਡੇ ਕੋਲ ਇਹਦੇ ਨਾਲ ਹੋਇਆ ਹੈਗਾ ਹੈ ਜਿੱਦਾਂ ਹੁਣ ਸਾਡੇ ਕੋਲ ਪੈਸਾ ਆਇਆ ਹੈ ਜ਼ਿਆਦਾ ਪੈਸਾ ਆਉਣ ਕਰਕੇ ਸਾਡੇ ਕੋਲ ਟਕ ਅਸੀਂ ਵਧੀਆ 'ਤੇ ਵਧੀਆ ਟੈਕਨੋਲੋਜੀ ਲੈ ਸਕਦੇ ਹੈਗੇ ਹੈ ਪਹਿਲਾਂ ਹਲਟਾਂ ਨਾਲ ਖੇਤੀ ਹੁੰਦੀ ਸੀ ਹੁਣ ਸਾਡੇ ਕੋਲ ਸਮਰਸੀਪਲ ਪੰਪ ਲੱਗ ਗਏ ਵੇ ਹੈ ਠੀਕ ਨਹੀਂ ਹੈਗਾ ਜੀ ਹਾਂਜੀ ਹਾਂਜੀ ਸੋ ਇੱਦਾਂ ਲੱਗਣ ਕਰਕੇ ਹੁਣ ਸਾਡੇ ਕੋਲ ਟੈਕਨੋਲੋਜੀ ਵਧੀ ਪਹਿਲਾਂ ਕੁ ਉਨ੍ਹਾਂ ਨਾਲ ਬਲ੍ਹਦਾਂ ਨਾਲ ਕਰਦੇ ਹੁੰਦੇ ਤੇ ਅਤੇ ਹੁਣ ਆਪਾਂ ਟਰੈਕਟਰਾਂ ਨਾਲ ਖੇਤ ਜੋਤਦੇ ਹੈਗੇ ਹੈ ਠੀਕ ਨਹੀਂ ਹੈਗਾ ਜੀ ਹਾਂ ਹਾਂ ਹਾਂ ਹਾਂ ਇਹਦੇ ਨਾਲ ਸਾਡੀ ਭਾਅ ਜੀ ਜਿੱਦਾਂ ਹੁਣ ਸਾਡੇ ਕੋਲ ਝਾੜ੍ਹ ਜ਼ਿਆਦਾ ਆਇਆ ਹੈਗਾ ਹੈ ਪਹਿਲਾਂ ਪਹਿਲਾਂ ਜਿੱਦਾਂ ਹੁਣ ਮੰਨ ਲਓ ਪਹਿਲਾਂ ਸਾਡੇ ਕੋਲ ਮਤਲਬ ਦੋ ਕੋਆਂਟਲ ਝਾੜ੍ਹ ਹੁੰਦਾ ਤਾਂ ਹੁਣ ਸਾਡੇ ਕੋਲ ਦਸ ਕੋਆਂਟਲ ਝਾੜ੍ਹ ਹੁੰਦਾ ਹੈਗਾ ਹੈ ਹੁਣ ਜੇ ਆਪਾਂ ਦਸ ਕੋਆਂਟਲ ਦਾ ਰੇਟ ਤਾਂ ਉਨ੍ਹਾਂ ਹੀ ਹੈ ਜ਼ਮੀਨ ਵੀ ਉਨ੍ਹੀਂ ਹੈ ਹੁਣ ਤੁਹਾਡਾ ਖ਼ਰਚਾ ਘੱਟ ਹੁੰਦਾ ਸਾਨੂੰ ਉੱਦਾਂ ਝਾੜ੍ਹ ਜ਼ਿਆਦਾ ਮਿਲਦਾ ਪੈਸੇ ਵੀ ਸਾਡੇ ਕੋਲ ਜ਼ਿਆਦਾ ਆਉਂਦੇ ਹੈਗੇ ਹੈ ਠੀਕ ਨਹੀਂ ਹੈਗਾ ਇਹਦਾ ਭਾਅ ਜੀ ਸਾਡੇ ਕੋਲ ਨੁਕਸਾਨ ਸਿਰਫ਼ ਔਰ ਸਿਰਫ਼ ਇੰਨਾਂ ਹੀ ਹੋਇਆ ਹੈਗਾ ਹੈ ਵੀ ਜਿੱਦਾਂ ਹੁਣ ਇਹਦੇ ਕਰਕੇ ਆਪਾਂ ਜਿਹੜੇ ਫਰਟੀਲਾਈਜ਼ਰ ਨਹੀਂ ਹੈਗੇ ਹੈ ਕੀਟਨਾਸ਼ਕ ਦਵਾਈਆਂ ਉਹ ਨਾ ਆਪਾਂ ਉਹ ਆਪਾਂ ਜ਼ਿਆਦਾ ਛਿੜਕਾਉਣੀਆਂ ਸ਼ੁਰੂ ਕਰ ਦਿੱਤੀਆਂ ਵਾ ਹੈ ਜ਼ਿਆਦਾ ਛਿੜਕਾਉਣ ਨਾਲ ਭਾਅ ਜੀ ਹੁਣ ਸਾਨੂੰ ਪਤਾ ਹੈ ਤੁਹਾਨੂੰ ਪਤਾ ਵੇ ਉਹ ਬਿਮਾਰੀਆਂ ਲੱਗਣ ਲੱਗ ਪੈਣੀਆਂ ਸਾਨੂੰ ਵੀ ਫਿਰ ਹੁਣ ਅੱਗੇ ਅੱਗਾ ਆਹ ਬੀ ਆਹ ਬੀ ਪੀ ਸ਼ੂਗਰ ਸਾਰੀ ਇਹਨਾਂ ਦੀ ਉਹ ਦੇਣ ਹੈ ਜੀ ਹਾਂਜੀ ਹਾਂਜੀ ਭਾਅ ਜੀ ਕੋਈ ਗੱਲ ਨਹੀਂ ਭਾਅ ਜੀ ਕੋਈ ਗੱਲ ਹੀ ਨਹੀਂ ਓਕੇ ਭਾਅ ਜੀ ਧੰਨ ਵੈਲਕੱਮ ਜੀ